ਜਿਵੇਂ ਕੀ ਤੁਸੀਂ ਜਾਣਦੇ ਹੋ ਕੀ ਸਾਡੇ ਲਈ ਖੇਡਾਂ ਬਹੁਤ ਜ਼ਰੂਰੀ ਹਨ ਅਤੇ ਸਾਡੇ ਸਾਡੇ ਲਈ ਨਹੀਂ ਸਾਡੇ ਬਜ਼ੁਰਗ ਸਾਡੇ ਮਾਤਾ ਪਿਤਾ ਸਾਡੇ ਭੈਣ ਭਰਾ ਆਦਿ ਲਈ ਖੇਡਾਂ ਸਭ ਤੋਂ ਜ਼ਰੂਰੀ ਹੈ ਖੇਡਾਂ ਖੇਡਣ ਨਾਲ ਸਾਡਾ ਮਨ ਤ ਮਨ ਸੰਤੁਲਿਤ ਰਹਿੰਦਾ ਹੈ ਅਤੇ ਸਾਨੂੰ ਤਾਕਤ ਅਤੇ ਐਨਰਜੀ ਪ੍ਰਾਪਤ ਹੁੰਦੀ ਹੈ ਇਹਦਾ ਇਹ ਖੇਡਾਂ ਖੇਡਣ ਦੇ ਨਾਲ ਸਾਡਾ ਮਨ ਭਰਿਆ ਰਹਿੰਦਾ ਹੈ ਅਤੇ ਸਾਨੂੰ ਬੁਰੇ ਕੰਮਾਂ ਤੋਂ ਦੂਰ ਰੱਖਿਆ ਜਾਂਦਾ ਹੈ ਖੇਡਾਂ ਖੇਡਣ ਨਾਲ ਸਾਨੂੰ ਤਾਕਤ ਮਿਲਦੀ ਹੈ ਖੇਡਾਂ ਖੇਡਾਂ ਖੇਡਣ ਦੇ ਨਾਲ ਬੰਦਾ ਕਦੇ ਵੀ ਥੱਕਦਾ ਨਹੀਂ ਹੈ ਖੇਡਾਂ ਮਨ ਦੇ ਰਾਹ ਮਨ ਨੂੰ ਪ੍ਰੋਪਰ ਤਰੀਕੇ ਨਾਲ ਤਿਆਰ ਕਰਾ ਕੇ ਰੱਖਦੀਆਂ ਹਨ ਖੇਡਾਂ ਖੇਡਣ ਨਾਲ ਬੰਦੇ ਨੂੰ ਮਨੋਰੰਜਨ ਅਤੇ ਮਨੋਰੰਜਨ ਹੁੰਦਾ ਹੈ ਅਤੇ ਤਨਾਅ ਤੋਂ ਰਾਹਤ ਮਿਲਦੀ ਹੈ ਅਤੇ ਖੇਡਾਂ ਖੇਡਣ ਦੇ ਨਾਲ ਬੰਦਾ ਆਪਣੇ ਆਪ ਨੂੰ ਬਿਜੀ ਬਿਜੀ ਫੀਲ ਕਰਦਾ ਹੈ ਪਰ ਖੇਡਾਂ ਦਾ ਅਸਲ ਰੂਪ ਵਿੱਚ ਖੇਡਾਂ ਸਾਨੂੰ ਸਾਡੇ ਲਈ ਬਹੁਤ ਜ਼ਰੂਰੀ ਹਨ ਜਰਾ ਕੰਮ ਦੇ ਨਾਲ ਸਾਨੂੰ ਖੇਡਾਂ ਵੀ ਖੇਡਣ ਨਾਲ ਮੌਕਾ ਮਿਲਦਾ ਹੈ ਖੇਡਾਂ ਸਭ ਲਈ ਬਹੁਤ ਜ਼ਰੂਰੀ ਹੁੰਦੀ ਹੈ ਖੇਡਾਂ ਖੇਡਣ ਦੇ ਨਾਲ ਸਾਨੂੰ ਆਪਣੇ ਦਿਨ ਚਰਿਆ ਬਣੀ ਰਹਿੰਦੀ ਹੈ ਸਵੇਰੇ ਉੱਠਣਾ ਤਾਜ਼ਾ ਹਵਾ ਲੈਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਖੇਡਾਂ ਖੇਡਣ ਦੇ ਨਾਲ ਸਾਡਾ ਸਰੀਰ ਖੁੱਲਦਾ ਹੈ ਅਤੇ ਅਤੇ ਸਾਡਾ ਖੂਨ ਵੱਧਦਾ ਰਹਿੰਦਾ ਹੈ ਖੇਡਾਂ ਨਾਲ ਹੀ ਸਾਡਾ ਜੀਵਨ ਹੈ ਖੇਡਾਂ ਨਾਲ ਹੀ ਸਾਡੀ ਸ਼ਾਨ ਹੈ ਖੇਡਾਂ ਖੇਡਣ ਦੇ ਨਾਲ ਜਿਵੇਂ ਕਿ ਤੁਸੀਂ ਮੰਨਦੇ ਹੋ ਕਿ ਸਾਡੇ ਪੰਜਾਬ ਵਿੱਚ ਖੇਡਾਂ ਦਾ ਤਾਂ ਪ੍ਰਚਾਰ ਬਹੁਤ ਸਾਰਾ ਹੈ ਜਿਵੇਂ ਕਿ ਹਰ ਇੱਕ ਬੰਦਾ ਖੇਡ ਖੇਡਣ ਲਈ ਬਹੁਤ ਉਤਸੁਕ ਹੁੰਦਾ ਹੈ ਜਿਵੇਂ ਕਿ ਤੁਸੀਂ ਮੰਨਦੇ ਹੋ ਖੇਡ ਖੇਡਣ ਦੇ ਨਾਲ ਹੀ ਬੰਦੇ ਦੀ ਜੀਵਨ 'ਚ ਬੰਦੇ ਦੇ ਸਰੀਰ ਵਿੱਚ ਜਾਨ ਆਉਂਦੀ ਹੈ ਉਵੇਂ ਹੀ ਸਾਨੂੰ ਮੇਨ ਖ਼ਾਸ ਕਰਕੇ ਮੈਂ ਆਪਣੀ ਗੱਲ ਕਰਦਾ ਮੈਨੂੰ ਖੇਡਾਂ ਖੇਡਣ ਦੇ ਨਾਲ ਬਹੁਤ ਪ੍ਰਸ਼ੰਸਾ ਹੁੰਦੀ ਹੈ ਮੇਰੇ ਅੰਦਰ ਕੁੱਟ ਕੁੱਟ ਕੇ ਜਾਨ ਆਉਂਦੀ ਹੈ ਖੇਡਾਂ ਖੇਡਣ ਦੇ ਨਾਲ ਕਦੇ ਬੰਦਾ ਥੱਕਦਾ ਨਹੀਂ ਖੇਡਾਂ ਖੇਡਣ ਦੇ ਨਾਲ ਕਦੇ ਤਨਾਅ ਨਹੀਂ ਹੁੰਦਾ ਖੇਡਾਂ ਖੇਡਣ ਦੇ ਨਾਲ ਹੀ ਬੰਦੇ ਦੇ ਜਾਨ ਆਉਂਦੀ ਖੇਡਾਂ ਖੇਡਣ ਨਾਲ ਹੀ ਤਾਕਤ ਬਣਦੀ ਹੈ